ਉੱਦਮੀ ਉਹ ਹੁੰਦਾ ਹੈ ਜਿਹੜਾ ਇੱਕ ਨਵਾਂ ਆਈਡੀਆ ਲੈ ਕੇ ਬਿਜ਼ਨਸ ਨੂੰ ਸ਼ੁਰੂ ਕਰੇ ਸੋ ਕਿਸੇ ਵੀ ਦੇਸ਼ ਦੇ ਲਈ ਵੱਧ ਤੋਂ ਵੱਧ ਉੱਦਮੀਆਂ ਦਾ ਹੋਣਾ ਹੋਣ ਦੇ ਨਾਲ ਉਹਨਾਂ ਉਸ ਦੇਸ਼ ਦੀ ਅਰਥ ਵਿਵਸਥਾ ਏ ਜਿਹੜੀ ਉਹ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਸੋ ਇਸੇ ਕਰਕੇ ਭਾਰਤ ਸਰਕਾਰ ਵੀ ਹੈ ਜਿਹੜੀ ਉਹ ਉੱਦਮੀਆਂ ਦੇ ਲਈ ਇੱਕ ਉੱਭਰਦੇ ਯੁੱਗ ਦਾ ਆਨੰਦ ਮਾਣ ਰਹੀ ਹੈ ਇਸੇ ਕਰਕੇ ਸਾਡੀਆਂ ਸਰਕਾਰਾਂ ਨੇ ਆ ਜਿਹੜੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਬਹੁਤ ਸਾਰੀਆਂ ਯੋਜਨਾਵਾਂ ਨੇ ਉਹ ਜਿਹੜੀਆਂ ਉੱਦਮੀਆਂ ਦੇ ਲਈ ਕਾਰੋਬਾਰੀਆਂ ਦੇ ਲਈ ਹੈ ਜਿਹੜੀਆਂ ਸ਼ੁਰੂ ਕੀਤੀਆਂ ਹਨ ਜਿਵੇਂ ਕਿ ਸਟਾਰਟਅਪ ਇੰਡੀਆ ਸਕੀਮ ਜਿਹੜੀ ਕਿ ਦੋ ਹਜ਼ਾਰ ਸੋਲ੍ਹਾਂ ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ ਉਹਦਾ ਮੇਨ ਜਿਹੜਾ ਮੰਤਵ ਸੀਗਾ ਉਹ ਇਹ ਸੀਗਾ ਕਿ ਜਿਹਨਾਂ ਲੋਕਾਂ ਦੇ ਕੋਲ ਨਵੇਂ ਨਵੇਂ ਆਈਡੀਆਜ ਹੈਗੇ ਨੇ ਪਰ ਉਹਨਾਂ ਕੋਲ ਫੰਡ ਨਹੀਂ ਹੈਗੇ ਆਪਣੇ ਬਿਜ਼ਨਸ ਨੂੰ ਚਲਾਉਣ ਦੇ ਲਈ ਤਾਂ ਉਹਨਾਂ ਦੀ ਫੈਨੇਸ਼ੀਅਲ ਹੈਲਪ ਹੈ ਜਿਹੜੀ ਉਹ ਸਰਕਾਰ ਕਰਦੀ ਆ ਉਹਨਾਂ ਨੂੰ ਸੌਖੇ ਤਰੀਕੇ ਦੇ ਨਾਲ ਲੋਨ ਦਵਾਉਣ ਦਾ ਕੰਮ ਕੀਤਾ ਜਾਂਦਾ ਜਾਂ ਫਿਰ ਕਹਿ ਲਓ ਸ਼ੁਰੂ ਸ਼ੁਰੂ ਦੇ ਸਾਲਾਂ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਟੈਕਸ ਹੈ ਜਿਹੜਾ ਉਹ ਨਹੀਂ ਲਾਇਆ ਜਾਂਦਾ ਹੁੰਦਾ ਹੈਗਾ ਇਸ ਤਰੀਕੇ ਦੇ ਨਾਲ ਜਿਹੜੀ ਸਰਕਾਰਾਂ ਨੇ ਉਹ ਮਦਦ ਕਰਦੀਆਂ ਨੇ ਤਾਂ ਕਿ ਉਹ ਆਪਣੇ ਦੇਸ਼ ਦੇ ਉੱਦਮੀਆਂ ਨੂੰ ਆ ਜਿਹੜਾ ਹੋਰ ਉੱਪਰ ਤੱਕ ਲੈ ਕੇ ਆ ਸਕਣ ਅਤੇ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਹੈ ਜਿਹੜਾ ਉਹ ਉੱਪਰ ਲੈ ਕੇ ਜਾ ਸਕਣ ਇੱਦਾਂ ਦੇ ਇੱਕ ਹੋਰ ਸਕੀਮ ਹੈਗੀ ਹੈ ਸੀਡ ਫੰਡਿੰਗ ਸਕੀਮ ਹੈਗੀ ਹੈ ਜਿਹਦੇ ਵਿੱਚ ਨਵੇਂ ਨਵੇਂ ਉੱਦਮੀ ਨੇ ਜਿਹੜੇ ਉਹ ਆਪਣੇ ਬਿਜ਼ਨਸ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਜਿਹੜਾ ਉਹ ਆਪਣਾ ਜਿਹੜਾ ਉਹ ਕੈਪੀਟਲ ਹੈਗੀ ਆ ਜਿਹੜੀ ਉਹ ਪੂੰਜੀ ਹੈਗੀ ਆ ਉਹ ਲੈ ਸਕਦੇ ਹਨ